ਹਾਂਜੀ ਇਹ ਬਿਲਕੁਲ ਸੱਚ ਹੈ ਕਿ ਲੋਕਾਂ ਨੇ ਲਾਕਡਾਊਨ ਤੋਂ ਬਾਅਦ ਮੋਬਾਈਲ ਅਤੇ ਲੈਪਟੋਪ ਦੀ ਜਿਹੜੀ ਵਰਤੋਂ ਹੈ ਉਹ ਜ਼ਿਆਦਾ ਕਰਨੀ ਸ਼ੁਰੂ ਕਰ ਦਿੱਤੀ ਹੈ ਔਨਲਾਈਨ ਸਕੂਲਿੰਗ ਤਾਂ ਮੈਂ ਕਹਾਂਗੀ ਕਿ ਇੱਕ ਫੇਲੀਅਰ ਹੈ ਔਨਲਾਈਨ ਸਕੂਲਿੰਗ ਦੇ ਵਿੱਚ ਤੁਸੀਂ ਕੁਝ ਬੱਚੇ ਨੂੰ ਨਹੀਂ ਸਿਖਾ ਸਕਦੇ ਹੈਗੇ ਜੋ ਮੇਰਾ ਐਕਸਪੀਰੀਅੰਸ ਮੇਰਾ ਤਜੁਰਬਾ ਕਹਿੰਦਾ ਹੈ ਉਹ ਕਹਿੰਦਾ ਕਿ ਨਹੀਂ ਔਨਲਾਈਨ ਸਕੂਲਿੰਗ ਬਿਲਕੁਲ ਵੀ ਨਹੀਂ ਹੋਣੀ ਚਾਹੀਦੀ ਹੈਗੀ ਹੋ ਸਕਦਾ ਕਿ ਹਾਂ ਜਿਵੇਂ ਹੁਣ ਕਰੋਨਾ ਦੇ ਟਾਈਮ ਮਹਾਂਮਾਰੀ ਸੀਗੀ ਤਾਂ ਉਸ ਟਾਈਮ ਠੀਕ ਹੈ ਇਹ ਵਧੀਆ ਸੀ ਵਧੀਆ ਇੱਕ ਔਪਸ਼ਨ ਸੀਗੀ ਕਿਉਂਕਿ ਹੋਰ ਔਪਸ਼ਨ ਨਹੀਂ ਸੀ ਸਾਡੇ ਕੋਲ ਬਟ ਅਦਰਵਾਈਜ਼ ਔਨਲਾਈਨ ਸਕੂਲਿੰਗ ਦਾ ਮਤਲਬ ਕੋਈ ਫਾਇਦਾ ਨਹੀਂ ਹੈਗਾ ਬੱਚਾ ਕੁਝ ਵੀ ਜ਼ਿਆਦਾ ਲਰਨ ਨਹੀਂ ਕਰਦਾ ਹੈਗਾ ਉਹ ਪੇਰੈਂਟਸ ਨੂੰ ਹੀ ਲਰਨ ਕਰਵਾਉਣਾ ਪੈਂਦਾ ਹੈ ਅਤੇ ਕੰਮ ਘਰ ਤੋਂ ਕੰਮ ਕਰਨ ਦਾ ਤੁਹਾਡਾ ਜਿਹੜਾ ਤਜੁਰਬਾ ਏ ਉਹ ਵਧੀਆ ਸੀ ਬਟ ਇਹ ਨਹੀਂ ਕਹਿ ਸਕਦੇ ਕਿ ਹਰ ਚੀਜ਼ ਤੁਹਾਨੂੰ ਮਤਲਬ ਹਰ ਫੈਸੇਲਿਟੀ ਤੁਹਾਨੂੰ ਮਿਲ ਗਈ ਕੰਮ ਕਰਨ ਦੀ ਇਹ ਵੀ ਇੱਕ ਤਰ੍ਹਾਂ ਦੀ ਔਪਸ਼ਨ ਹੀ ਸੀਗੀ ਕਿ ਜਦੋਂ ਤੁਸੀਂ ਘਰ ਕੰਮ ਕਰਦੇ ਹੋ ਤਾਂ ਵਿੱਚ ਉਹ ਡਿਸਟਰਬੈਂਸਿਸ ਬਹੁਤ ਜ਼ਿਆਦਾ ਹੋ ਜਾਂਦੀਆਂ ਨੇ ਤੁਸੀਂ ਘਰ ਕੰਮ ਕਰ ਰਹੇ ਤੁਹਾਨੂੰ ਘਰ ਦਾ ਵੀ ਕੰਮ ਨਾਲ ਕਰਨਾ ਪੈਂਦਾ ਸੀਗਾ ਅਤੇ ਤੁਹਾਨੂੰ ਵਿੱਚ ਆਫਿਸ ਦਾ ਕੰਮ ਵੀ ਨਾਲ ਕਰਨਾ ਪੈਂਦਾ ਸੀ ਤਾਂ ਇਸ ਲਈ ਮੈਂ ਇਹ ਕਹਾਂਗੀ ਕਿ ਜਿਹੜਾ ਵਧੀਆ ਔਪਸ਼ਨ ਹੈ ਕਿ ਜਿੱਥੇ ਜੇ ਸਕੂਲ ਹੈ ਤਾਂ ਸਕੂਲ ਦੇ ਵਿੱਚ ਪੜ੍ਹਾਈ ਹੋਣੀ ਚਾਹੀਦੀ ਹੈ ਅਤੇ ਜੇ ਆਫਿਸ ਦਾ ਕੰਮ ਹੈ ਤਾਂ ਉਹ ਆਫਿਸ ਦੇ ਵਿੱਚ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਕੀਤਾ ਜਾ ਸਕਦਾ ਹੈ